ਸਰਕਾਰ ਔਰਤਾਂ ਦੀ ਉੱਚ ਸਿੱਖਿਆ ਲਈ ਬਹੁਤ ਸਾਰੇ ਕਦਮ ਚੁੱਕ ਰਹੀਆਂ ਨੇ ਜਿਵੇਂ ਕਿ ਉਹਨਾਂ ਨੇ ਪੜ੍ਹਾਈ ਦੀ ਫੀਸ ਮਾਫ ਕੀਤੀ ਗਈ ਹੈ ਤੇ ਉਹਨਾਂ ਦੀ ਸਕੂਲ ਕਾਲਜ ਦਾ ਨੇੜੇ ਦੇ ਨੇੜੇ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਔਰਤਾਂ ਨੂੰ ਕਿੱਤੇ ਜਰੂਰ ਜਾਣਾ ਨਾ ਪਵੇ ਤੇ ਉਹਨਾਂ ਦੀ ਸਿਹਤ ਲਈ ਡਿਸਪੈਂਸਰੀ ਵੀ ਖੁੱਲੀਆਂ ਗਈਆਂ ਹਨ ਤੇ ਆਸ਼ਾ ਵਰਕਰ ਉਹਨਾਂ ਦੇ ਘਰ ਘਰ ਜਾ ਕੇ ਉਹਨਾਂ ਦੀ ਸਿਹਤ ਦਾ ਹਾਲ ਚਾਲ ਪੁੱਛਦੀ ਹੈ ਇੱਕ ਲਿਸਟ ਤਿਆਰ ਕਰਦੀ ਹੈ ਧੰਨਵਾਦ